ਪੰਜਾਬ ਰੋਡਵੇਜ਼ ਅਤੇ ਪੰਜਾਬ ਟਰਾਂਸਪੋਰਟ ਦੀ ਨਿਰਾਸ਼ਾਜਨਕ ਹਾਲਤ ਹੈ ਜੀ ਜਿਸ ਦੇ ਵਿੱਚ ਗੱਡੀਆਂ ਦੀ ਸਫਾਈ ਦਾ ਬਿਲਕੁਲ ਧਿਆਨ ਨਹੀਂ ਦਿੱਤਾ ਜਾਂਦਾ ਡਰਾਈਵਰ ਸਮੇਂ ਸਿਰ ਨਹੀਂ ਪਹੁੰਚਦੇ ਉਹਨਾਂ ਦੇ ਰੱਖ ਰਖਾਵ ਦਾ ਕੇਅਰ ਟੇਕਿੰਗ ਦਾ ਸਿਸਟਮ ਬਹੁਤ ਹੀ ਮਾੜਾ ਹੈ ਅਤੇ ਜਿਸ ਦੇ ਨਾਲ ਸਵਾਰੀਆਂ ਨੂੰ ਅਤੇ ਸਮੇਂ ਸਿਰ ਪੁੱਜਣਾ ਬੜਾ ਮੁਸ਼ਕਿਲ ਹੋ ਗਿਆ ਹੈ ਡਰਾਈਵਰ ਅਤੇ ਕੰਡਕਟਰ ਦੀ ਬੋਲਬਾਣੀ ਬਹੁਤ ਨੀਵੇਂ ਪੱਧਰ ਦੀ ਹੈ ਇਸਤਰੀ ਮੁਲਾਜ਼ਮਾਂ ਨੂੰ ਜਾਂ ਇਸਤਰੀ ਜਿਹੜੀਆਂ ਕੁੜੀਆਂ ਨੇ ਜਾਂ ਇਸਤਰੀਆਂ ਨੇ ਉਹਨਾਂ ਨੂੰ ਵੱਡੀ ਨਿਰਾਸ਼ਾ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਥਾਂ ਥਾਂ 'ਤੇ ਟਰੈਫਿਕ ਰੁੱਕਣ ਕਾਰਨ ਗੱਡੀਆਂ ਖਰਾਬ ਹੋਣ ਕਾਰਨ ਟਰੈਫਿਕ ਰੁੱਕ ਰਹੀ ਹੈ ਅਤੇ ਬਹੁਤ ਵੱਡੀ ਸਮੱਸਿਆ ਦਿਨ ਪ੍ਰਤੀ ਦਿਨ ਪੰਜਾਬ ਦੇ ਅੰਦਰ ਵੱਧਦੀ ਜਾ ਰਹੀ ਹੈ ਜਿਸ ਦੇ ਨਾਲ ਸਾਡੇ ਹਾਲਾਤ ਬਹੁਤ ਹੀ ਨਾਜੁਕ ਬਣਦੇ ਜਾ ਰਹੇ ਹਨ